ਪੇਂਟਿੰਗ ਵਿੱਚ ਮੈਂ ਪੈਂਸਿੰਲ ਕਲਰ ਯੂਜ ਕਰਦੀ ਹਾਂ ਵਾਟਰ ਕਲਰ ਯੂਜ਼ ਕਰਦੀ ਹਾਂ ਅਤੇ ਜੋ ਦੂਜੇ ਹੁੰਦੇ ਆ ਪੈਂਸਿਲਾਂ ਨਾਲ ਕਰਕੇ ਸਿੰਪਲ ਪੈਂਸਿਲ ਕਲਰ ਹੁੰਦੇ ਉਹ ਵੀ ਹੁੰਦੇ ਆ ਉਹਨਾਂ ਨਾਲ ਵੀ ਕਰਦੀ ਹਾਂ ਕਈ ਤਰ੍ਹਾਂ ਦੇ ਕਲਰ ਮਿਕਸ ਕਰਕੇ ਮੈਂ ਕਈ ਤਰ੍ਹਾਂ ਦੀ ਪੇਂਟਿੰਗ ਬਣਾ ਲੈਂਦੀ ਹਾਂ ਪੇਂਟਿੰਗ ਬਣਾਉਣ ਦਾ ਮੈਨੂੰ ਬਹੁਤ ਸ਼ੌਂਕ ਹੈ ਇਹ ਜਿਵੇਂ ਜਿਵੇਂ ਅੱਡ ਅੱਡ ਤਰ੍ਹਾਂ ਦੇ ਕਲਰ ਆਉਂਦੇ ਆ ਉਸ ਰਾਹੀਂ ਮੈਂ ਪੇਂਟਿੰਗ ਨੂੰ ਉਸ ਦੀ ਤੱਕ ਲੈ ਕੇ ਜਾਂਦੀ ਹਾਂ ਕਿ ਕਿਵੇਂ ਕਿੱਦਾਂ ਦਾ ਕਲਰ ਕਿਸ ਪੇਂਟਿੰਗ 'ਤੇ ਕਿਸ ਕਲਰ 'ਤੇ ਜਚੇਗਾ ਇਸ ਤਰ੍ਹਾਂ ਮੈਂ ਆਪਣੀ ਪੇਂਟਿੰਗ ਸ਼ੁਰੂ ਕਰਦੀ ਹਾਂ ਕਈ ਤਰ੍ਹਾਂ ਦੇ ਕਲਰ ਮਿਕਸ ਕਰਕੇ ਜਿਵੇਂ ਵਾਟਰ ਕਲਰ ਪਰ ਵਾਟਰ ਪਾਣੀ ਕਲਰ ਵਾਟਰ ਕਲਰ ਪਾਣੀ ਵਾਲੇ ਕਲਰ ਦੂਜੇ ਕਲਰ ਪੈਂਸਿਲ ਵਾਲੇ ਕਰਾਂ ਸਾਰੇ ਵਰਤ ਕੇ ਮੈਂ ਆਪਣਾ ਆਪਣੀ ਕਲਾਕਾਰੀ ਨੂੰ ਅੰਜਾਮ ਦਿੰਦੀ ਹਾਂ